ਹਾਂ ਆਪਾਂ ਖ਼ਬਰਾਂ ਨੂੰ ਬਹੁਤ ਵਾਰ ਪੜ੍ਹਦੇ ਹਾਂ ਸੁਣਦੇ ਹਾਂ ਅਗਰ ਆਪਾਂ ਟੀ ਵੀ ਨਿਊਜ਼ ਦੀ ਗੱਲ ਕੀਤੀ ਜਾਵੇ ਤਾਂ ਆਜ ਤੱਕ ਜੋ ਖ਼ਬਰਾਂ ਵਾਲਾ ਚੈਨਲ ਹੈ ਆਪਾਂ ਉਹਨਾਂ ਨੂੰ ਸੁਣਦੇ ਹਾਂ ਹਾਂ ਅਗਰ ਅਰ ਅਖ਼ਬਾਰ ਦੀ ਗੱਲ ਕੀਤੀ ਜਾਵੇ ਕਿ ਆਪਾਂ ਸਵੇਰੇ ਜਦੋਂ ਉੱਠਦੇ ਹਾਂ ਆਪਾਂ ਦਸ ਮਿੰਟ ਦਾ ਹਮੇਸ਼ਾ ਸਾਡਾ ਬ੍ਰੇਕ ਹੁੰਦਾ ਕਿ ਹਾਂ ਸਾਨੂੰ ਕਿ ਅਖ਼ਬਾਰ ਪੜ੍ਹਨੀ ਹੀ ਪੜ੍ਹਨੀ ਆ ਅਗਰ ਆਪਾਂ ਦੇਖਿਆ ਜਾਵੇ ਮਨੋਰੰਜਨ ਦਾ ਸਾਧਨ ਮਨੋਰੰਜਨ ਵਿੱਚ ਕੀ ਹੁੰਦਾ ਕਿ ਉਹ ਅਖ਼ਬਾਰ ਦੇ ਵਿੱਚ ਗੇਮਸ ਵਗੈਰਾ ਹੁੰਦੀਆਂ ਕਿ ਬੱਚਿਆਂ ਨੂੰ ਸਭ ਤੋਂ ਪਹਿਲੇ ਚਲੋ ਉਹਨਾਂ ਨੇ ਪੜ੍ਹਨਾ ਹੋਵੇ ਅਖ਼ਬਾਰ ਨਾ ਪੜ੍ਹਨਾ ਹੋਵੇ ਲੇਕਿਨ ਉਹ ਗੇਮਸ ਜ਼ਰੂਰ ਖੇਲਦੇ ਹਨ ਸ਼ੂਡੂਕੋ ਗੇਮ ਹੁੰਦੀ ਹੈ ਜੋ ਹਰ ਅਖ਼ਬਾਰ ਵਿੱਚ ਹੁੰਦੀ ਹੀ ਹੁੰਦੀ ਹੈ ਉਹ ਕੀ ਹੈ ਇੱਕ ਤਾਂ ਸਾਨੂੰ ਉਸ ਤਰ੍ਹਾਂ ਦੀਆਂ ਟ੍ਰਿਕਾਂ ਮਤਲਬ ਇੱਕ ਤਰ੍ਹਾਂ ਦੇ ਲੋਜ਼ਿਕ ਵਗੈਰਾ ਵੀ ਸਮਝਾਉਂਦੇ ਹਨ ਅਗਰ ਆਪਾਂ ਵਪਾਰ ਦੀ ਗੱਲ ਕੀਤੀ ਜਾਵੇ ਵਪਾਰ ਦੇ ਬਹੁਤ ਸਾਰੇ ਇੱਦਾਂ ਦੇ ਮਤਲਬ ਦਿੱਤੇ ਜਾਂਦੇ ਹਨ ਹੈੱਡ ਲਾਈਨਜ ਦਿੱਤੀਆਂ ਜਾਂਦੀਆਂ ਹਨ ਅਗਰ ਕਿਸੇ ਨੂੰ ਕੰਮ ਦੀ ਜ਼ਰੂਰਤ ਹੋਵੇ ਤਾਂ ਉਹ ਸਾਨੂੰ ਇੱਥੇ ਸੰਪਰਕ ਕਰੇ ਅਗਰ ਸਾਨੂੰ ਕੋਈ ਜੋਬਸ ਦੀ ਜ਼ਰੂਰਤ ਹੋਵੇ ਤਾਂ ਆਪਾਂ ਦੇਖਦੇ ਹਾਂ ਉੱਥੇ ਮੇਨ ਹੈੱਡ ਲਾਈਨਜ ਦਿੱਤੀਆਂ ਜਾਂਦੀਆਂ ਹਨ ਕਿ ਇਸ ਜਗ੍ਹਾ 'ਤੇ ਸਾਨੂੰ ਮਤਲਬ ਜੋਬ ਹੈਗੀ ਆ ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਹ ਸਾਡਾ ਨੰਬਰ ਹੈ ਜਾਂ ਇਸ ਚੀਜ਼ 'ਤੇ ਕੰਟੈਕਟ ਵਗੈਰਾ ਕਰੋ ਇਹ ਸਭ ਚੀਜ਼ਾਂ ਸਾਨੂੰ ਅਖ਼ਬਾਰ ਦੇ ਵਿੱਚ ਮਿਲ ਜਾਂਦੀਆਂ ਹਨ ਅਗਰ ਆਪਾਂ ਕਿਸੇ ਚੀਜ਼ ਦੇ ਬਾਰੇ ਜਾਂ ਕਿਸੇ ਅਗਰ ਆਪਾਂ ਕਿਸੇ ਵੀ ਫ਼ਿਲਮ ਇੰਡਸਟਰੀ ਦੇ ਵਿੱਚ ਕੋਈ ਸਾਡਾ ਵਧੀਆ ਐਕਟਰ ਹੈਗਾ ਅਗਰ ਆਪਾਂ ਉਹਨਾਂ ਦੇ ਬਾਰੇ ਕੋਈ ਚੀਜ਼ ਜਾਣਨਾ ਚਾਹੁੰਦੇ ਹਾਂ ਅਤੇ ਉਹ ਫਿਰ ਸਾਨੂੰ ਕੀ ਹੁੰਦਾ ਕਿ ਅਖ਼ਬਾਰ ਦੇ ਰਾਹੀਂ ਸਾਨੂੰ ਸਭ ਚੀਜ਼ਾਂ ਮਿਲ ਜਾਂਦੀਆਂ ਸਿੱਖਿਆ ਪੱਧਰ 'ਤੇ ਵੀ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਮਿਲਦੀਆਂ ਨੇ ਕਿਉਂਕਿ ਅੱਜ ਕੱਲ੍ਹ ਕੀ ਹੁੰਦਾ ਐਗਜ਼ਾਮ ਹੁੰਦੇ ਆ ਐਗਜ਼ਾਮ ਵਿੱਚ ਕੀ ਹੁੰਦਾ ਕਿ ਇਹ ਜਰਨਲ ਨੌਲੇਜ ਦੇ ਇਹ ਚੀਜ਼ਾਂ ਪੁੱਛੀਆਂ ਜਾਂਦੀਆਂ ਹਨ ਉਹ ਸਭ ਚੀਜ਼ਾਂ ਸਾਨੂੰ ਅਖ਼ਬਾਰ ਨਿਊਜ਼ ਪੇਪਰ ਦੀ ਜੋ ਸਾਡਾ ਲੇਟੈਸਟ ਹੁੰਦਾ ਉਹੀ ਚੀਜ਼ਾਂ ਤੋਂ ਸਾਡਾ ਕੀ ਹੁੰਦਾ ਐਗਜ਼ਾਮ ਤਿਆਰ ਕੀਤਾ ਜਾਂਦਾ ਹੈ ਰਾਜਨੀਤੀਆਂ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਪਾਰਲੀਮੈਂਟ ਦੇ ਬਾਰੇ ਦੱਸਿਆ ਜਾਂਦਾ ਇਹ ਸਭ ਚੀਜ਼ਾਂ ਸਾਡੇ ਅਖ਼ਬਾਰ ਦੇ ਵਿੱਚ ਦੱਸੀ ਜਾਂਦੀ ਹੈ ਮਤਲਬ ਹਾਂ ਸਾਡੇ ਤਾਂ ਅਖਬਾਰ ਪੜ੍ਹਨਾ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਮਤਲਬ ਹਰ ਕਿਸੇ ਨੂੰ ਅਖ਼ਬਾਰ ਪੜ੍ਹਨੀ ਜਾਂ ਨਿਊਜ਼ ਚੈਨਲ ਦੇਖਣਾ ਬਹੁਤ ਹੀ ਜ਼ਿਆਦਾ ਹਾ ਜ਼ਰੂਰੀ ਕਰ ਦਿੱਤਾ ਜਾਣਾ ਚਾਹੀਦਾ ਹੈ ਧੰਨਵਾਦ